ਸਾਡੇ ਖੇਤਰ ਦੇ ਵਿੱਚ ਕੋਈ ਵੀ ਇਹੋ ਜਿਹਾ ਹੋਸਪਿਟਲ ਨਹੀਂ ਹੈ ਜਿੱਥੇ ਐਕਸਰੇ ਸਿਟੀ ਸਕੈਨ ਅਤੇ ਐੱਮ ਆਰ ਆਈ ਸਕੈਨ ਵਰਗੀਆਂ ਸਹੂਲਤਾਂ ਮੌਜੂਦ ਹਨ ਇੱਕ ਤਾਂ ਪੇਂਡੂ ਖੇਤਰ ਹੈ ਇਹਦੇ ਵਿੱਚ ਕੀ ਆ ਕੋਈ ਡਾਕਟਰੀ ਸਹੂਲਤ ਨਹੀਂ ਆ ਨਾ ਕੋਈ ਪ੍ਰਾਈਵੇਟ ਹੋਸਪਿਟਲ ਆ ਜੋ ਵੀ ਕਿਸੇ ਨੂੰ ਸਿਹਤ ਸਬੰਧੀ ਕੋਈ ਦਿੱਕਤ ਆਉਂਦੀ ਆ ਉਹਨਾਂ ਨੂੰ ਦੂਰ ਦਾ ਸਫ਼ਰ ਤੈਅ ਕਰਕੇ ਸ਼ਹਿਰ ਜਾਣਾ ਪੈਂਦਾ ਆ ਜਿਹਦੇ ਨਾਲ ਕੀ ਆ ਕਈ ਵਾਰ ਤੋ ਇਸ ਤਰ੍ਹਾਂ ਕਰਦੇ ਕਿ ਉਹ ਟੈਸਟ ਕਰਾਉਣ ਤੱਕ ਵੀ ਨਹੀਂ ਜਾਂਦੇ ਅਤੇ ਇੱਥੇ ਹੀ ਆਪਣੇ ਘਰ ਬਹਿ ਕੇ ਘਰੇਲੂ ਜਿਹੜੇ ਨੁਸਖੇ ਅਪਣਾਉਂਦੇ ਨੇ ਜਿਹਦੇ ਨਾਲ ਕਿ ਉਹਨਾਂ ਦੀ ਤਬੀਅਤ ਜਿਹੜੀ ਹੋਰ ਦਿਨ ਬ ਦਿਨ ਖ਼ਰਾਬ ਹੁੰਦੀ ਜਾਂਦੀ ਹੈ ਅਤੇ ਕਈ ਵਾਰ ਜਿਹੜਾ ਮੌਤ ਦਾ ਕਾਰਨ ਜਿਹੜਾ ਬਣ ਜਾਂਦੀ ਆ ਅਤੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਗਵਰਨਮੈਂਟ ਨੂੰ ਚਾਹੀਦਾ ਵਾ ਕਿ ਵੱਧ ਤੋਂ ਵੱਧ ਜਿਹੜੇ ਕਲੀਨਿਕ ਜਿਹੜੇ ਖੋਲ੍ਹੇ ਜਾਣ ਅਤੇ ਇਹ ਜਿਹੜੇ ਸੁਪਰਵਿਜ਼ਨ ਉਹਨਾਂ ਦੀ ਕੀਤੀ ਜਾਵੇ ਟਾਈਮ ਟੂ ਟਾਈਮ ਆ ਕੇ ਕਿ ਜਿਹੜੇ ਵਰਕਰ ਉਹਦੇ ਕੰਮ ਕਰਦੇ ਪਏ ਆ ਕਿ ਨਹੀਂ ਅਤੇ ਜਿਹੜੀਆਂ ਵੀ ਤਕਨੀਕੀ ਜਿਹੜੀਆਂ ਸਹੂਲਤਾਂ ਉੱਥੇ ਮੌਜੂਦ ਹੋਣ ਹੋਸਪਿਟਲਾਂ ਵਿੱਚ ਅਤੇ ਜਿਹੜੇ ਵੀ ਕਲੀਨੀਕਲ ਦੇ ਜਿਹੜੇ ਸਟਾਫ ਆ ਉਹ ਕੀ ਆ ਐਕਸਪੀਰੀਅੰਸਡ ਹੋਣ ਕਿ ਮਤਲਬ ਮਾਹਿਰ ਹੋਣ ਹਰ ਇੱਕ ਸਪੈਸ਼ਲਿਟੀ ਦੇ ਨਾਲ ਇਹਦੇ ਨਾਲ ਕੀ ਆ ਜਿਹੜੇ ਪੇਂਡੂ ਖੇਤਰ ਆ ਉਹਨਾਂ ਦੇ ਲੋਕਾਂ ਨੂੰ ਜਿਹੜੀ ਆ ਸਸਤੇ ਰੇਟਾਂ 'ਤੇ ਜਿਹੜੀ ਦਵਾਈ ਜਿਹੜੀ ਆ ਉਹਨਾਂ ਨੂੰ ਉਪਲੱਬਧ ਵੀ ਹੋਏਗੀ ਸਰਕਾਰੀ ਹਸਪਤਾਲਾਂ ਵਿੱਚ ਅਤੇ ਜਿਹੜੇ ਆ ਉਹਨਾਂ ਨੂੰ ਕੀ ਆ ਕਿ ਜਿਹੜਾ ਇਲਾਜ ਕਰਾਉਣ ਦੇ ਲਈ ਪ੍ਰਾਈਵੇਟ ਹੋਸਪਿਟਲਾਂ ਦਾ ਜਿਹੜਾ ਸਹਾਰਾ ਵੀ ਨਹੀਂ ਲੈਣਾ ਪਵੇਗਾ ਜਿਹਦੇ ਨਾਲ ਕੀ ਆ ਉਹਨਾਂ ਦੀ ਆਮਦਨ 'ਤੇ ਇਫੈਕਟ ਪੈਂਦਾ ਹੋਵੇਗਾ